ਤੈਰਾਕੀ ਕਰਦੇ ਸਮੇਂ ਇੱਕ ਬਹੁਤ ਹੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਅਸੀਂ ਖੁੱਲ੍ਹੇ ਪਾਣੀ ਵਿੱਚ ਤੈ ਤੈਰਾਕੀ ਕਰ ਰਹੇ ਹਾਂ ਉਸ ਪਾਣੀ ਦਾ ਅਤੇ ਜਮੀਨ ਦਾ ਲ ਕਿੰਨਾ ਕੁ ਲੈਵਲ ਹੈ ਅਤੇ ਜੇ ਤੁਹਾਨੂੰ ਅੱਛੀ ਤਰ੍ਹਾਂ ਤੈਰਾਕੀ ਆਉਂਦੀ ਹੈ ਫਿਰ ਹੀ ਖੁੱਲ੍ਹੇ ਪਾਣੀ 'ਚ ਨਹਾਉਣਾ ਚਾਹੀਦਾ ਨਹੀਂ ਤਾਂ ਸਵੀਮਿੰਗ ਪੂਲ ਵਧੀਆ ਗੱਲ ਵਧੀਆ ਹੁੰਦੀ ਚੀਜ਼ ਕਿਉਂਕਿ ਉਸ ਉੱਥੇ ਕੋਚ ਹੁੰਦੇ ਹਨ ਅਤੇ ਉੱਥੇ ਪਾਣੀ ਦਾ ਲੈਵਲ ਲਿਖਿਆ ਹੁੰਦਾ ਜਗ੍ਹਾ ਦਾ ਮਤਲਬ ਕਿ ਇੰਨਾ ਇੰਚ ਹੈ ਇੰਨਾ ਫੁੱਟ ਹੈ ਜਾਂ ਜਿਸ ਤਰ੍ਹਾਂ ਵੀ ਬਟ ਉੱਥੇ ਕੋਚ ਕੋਚ ਵੀ ਹੁੰਦਾ ਹੈ ਜੇ ਤੁਹਾਨੂੰ ਸਵਿਮਿੰਗ ਸਿੱਖਣੀ ਹੈ ਜਾਂ ਕਿੱਦਾਂ ਵੀ ਕਰਕੇ ਉੱਥੇ ਮਤਲਬ ਬਹੁਤ ਤਰ੍ਹਾਂ ਦੀ ਹੈਲਪ ਹੋ ਜਾਂਦੀ ਹੈ ਅਤੇ ਜਿਹੜਾ ਖੁੱਲ੍ਹਾ ਪਾਣੀ ਦੇ ਵਿੱਚ ਹੈ ਉੱਥੇ ਕੋਈ ਇੱਦਾਂ ਦਾ ਇੱਦਾਂ ਦਾ ਨਹੀਂ ਹੁੰਦਾ ਸਿਸਟਮ ਕਿ ਜਿੱਦਾਂ ਕਿ ਤੁਹਾਨੂੰ ਕੋਈ ਡੂੰਘੇ ਪਾਣੀ ਤੋਂ ਜਾਣ 'ਚ ਰੋਕ ਬਚਾ ਸਕੇ ਜਾਂ ਕੁਛ ਵੀ ਕਰ ਸਕੇ ਇਸ ਕਰਕੇ ਖੁੱਲ੍ਹੇ ਪਾਣੀ 'ਚ ਨਹਾਉਣਾ ਤੇ ਤਾਂ ਹੀ ਚਾਹੀਦਾ ਹੈ ਜੇ ਤੁਹਾਨੂੰ ਅੱਛੀ ਤਰ੍ਹਾਂ ਤੈਰਾਕੀ ਆਉਂਦੀ ਹੈ ਰਹੀ ਗੱਲ ਤਿਲ ਇਹ ਵੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਤਿਲਕਣ ਵਾਲਾ ਹੋਏ ਆਪਣੇ ਜਾਂ ਚੱਟਾਨ ਵਾਲੀ ਜਗ੍ਹਾ ਹੋਏ ਉਸ 'ਤੇ ਵੀ ਨੁਕਸਾਨਦਾਇਕ ਹੋ ਸਕਦਾ ਹੈ ਇਸ ਨੂੰ ਲੈ ਕੇ ਕਿ ਜਿੱਦਾਂ ਵੀ ਪਾਣੀ ਡੂੰਘਾ ਹੈ ਤੁਹਾਡੇ ਨਾਲ ਕੋਈ ਨਹੀਂ ਹੈ ਤੁਸੀਂ ਇਕੱਲੇ ਹੋ ਬਟ ਉਸ ਲਈ ਜਾਨ ਜਾਨ 'ਤੇ ਵੀ ਬਣ ਆ ਸਕਦੀ ਹੈ